ਵੈਸੇ ਤਾਂ ਜੇਕਰ ਗੱਲ ਕੀਤੀ ਜਾਵੇ ਤਾਂ ਸਾਡੇ ਰਾਜ ਵਿੱਚ ਬਹੁਤ ਸਾਰੇ ਧਾਰਮਿਕ ਚੀਜ਼ਾਂ ਹਨ ਪ੍ਰੰਤੂ ਮੈਂ ਪੰਜਾਬ ਤੋਂ ਬਿਲੋਂਗ ਕਰਦਾ ਹਾਂ ਅਤੇ ਪੰਜਾਬ ਤੋਂ ਹੋਣ ਨਾਲ ਮੈਂ ਸਿੱਖ ਧਰਮ ਤੋਂ ਬਿਲੋਂਗ ਕਰਦਾ ਹਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਪੁਰਾਣੇ ਦਸ ਗੁਰੂ ਸਾਹਿਬਾਨ ਹਨ ਜਿਨ੍ਹਾਂ ਦੀ ਬਾਣੀ ਸ ਅਸੀਂ ਪੜ੍ਹ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁਝ ਸਿੱਖਦੇ ਹਾਂ ਉਨ੍ਹਾਂ ਦਸਾਂ ਗੁਰੂਆਂ ਦੀ ਬਾਣੀ ਦਾ ਨਿਚੋੜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਜੋ ਕਿ ਸਾਡੇ ਗਿਆਰ੍ਹਵੇਂ ਗੁਰੂ ਹਨ ਜਿਸ ਨੂੰ ਪੜ੍ਹਨ ਦੇ ਲਈ ਅਸੀਂ ਸਵੇਰੇ ਨਹਾ ਧੋ ਕੇ ਗੁਰਦੁਆਰੇ ਜਾਂਦੇ ਹਾਂ ਅਤੇ ਉੱਥੇ ਸ਼ਾਂਤ ਮਾਹੌਲ ਦੇ ਵਿੱਚ ਬੈਠ ਕੇ ਗੁਰਬਾਣੀ ਪੜ੍ਹਦੇ ਹਾਂ ਅਤੇ ਉਸ ਤੋਂ ਬਹੁਤ ਸਾਰੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ ਜਿਵੇਂ ਕਿ ਉਨ੍ਹਾਂ ਵਿੱਚੋਂ ਸਾਨੂੰ ਬਹੁਤ ਸਾਰੇ ਚੰਗੀਆਂ ਚੀਜ਼ਾਂ ਸਿੱਖਣ ਤੋਂ ਮਿਲਦੀਆਂ ਹਨ ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਦਾ ਬਹੁਤ ਹੀ ਡੂੰਘਾ ਬਿਆਨ ਕੀਤਾ ਜਾਂਦਾ ਹੈ ਜਿਸ ਦਾ ਅਰਥ ਕੱਢ ਕੇ ਸਾਨੂੰ ਸਮਝਣਾ ਚਾਹੀਦਾ ਹੈ ਜਿਸ ਦੇ ਵਿੱਚੋਂ ਸਾਨੂੰ ਬਹੁਤ ਸਾਰੀ ਸਿੱਖਿਆ ਮਿਲਦੀ ਹੈ